ਪੰਜਾਬੀ ਭਾਸ਼ਾ ਸਾਡੇ ਰਾਜ ਦੀਆਂ ਬਾਕੀ ਖੇਤਰੀ ਉਪਭਾਸ਼ਾ ਤੋਂ ਵੱਖਰੀ ਇਸ ਕਰਕੇ ਹੈ ਕਿਉਂਕਿ ਜਿਹੜੀ ਪੰਜਾਬੀ ਹੈ ਉਹ ਹਿੰਦੀ ਨਾਲ ਇੱਕ ਤਾਂ ਬਹੁਤ ਮੇਲ ਖਾਂਦੀ ਹੈ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ ਅਤੇ ਪੰਜਾਬੀ ਉਹਦੇ ਨਾਲ ਬਹੁਤ ਮਿਲਦੀ ਜੁਲਦੀ ਹੈ ਹੁਣ ਜੇਕਰ ਅਸੀਂ ਕਿਸੇ ਬੰਦੇ ਨੂੰ ਜਿਹਨੂੰ ਹਿੰਦੀ ਸਮਝ ਆਉਂਦੀ ਹੈ ਉਹਦੇ ਨਾਲ ਪੰਜਾਬੀ 'ਚ ਗੱਲ ਕਰਾਂਗੇ ਤਾਂ ਹੁਣ ਸਾਡੀ ਗੱਲ ਪੂਰੀ ਨਾ ਸਹੀ ਪਰ ਥੋੜ੍ਹੀ ਬਹੁਤ ਸਮਝ ਲੂਗਾ ਕਿਉਂਕਿ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਦੂਜਾ ਜਿਹੜਾ ਵੱਡਾ ਕਾਰਨ ਹੈ ਇਹ ਵੱਖਰੀ ਹੈ ਕਿਉਂਕਿ ਪੰਜਾਬੀ ਇੱਕ ਗੁਰਮੁਖੀ ਹੈ ਪੰਜਾਬੀ ਭਾਸ਼ਾ 'ਚ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਹੋਏ ਨੇ ਅਤੇ ਉਹ ਉਹ 'ਚ ਗੁਰਬਾਣੀ ਲਿਖੀ ਹੋਈ ਹੈ ਤਾਂ ਲੋਕਾਂ ਨੂੰ ਉਹ ਭਾਸ਼ਾ ਜਿਹੜੀ ਹੈ ਇਹਦੇ ਕਰਕੇ ਬੜੀ ਵੱਖਰੀ ਹੈ ਅਤੇ ਇੱਕ ਸਭ ਤੋਂ ਵੱਡਾ ਜਿਹੜਾ ਖੇਤਰ ਹੈ ਸਾਡੀ ਉਪਭਾਸ਼ਾ ਵੱਖਰੀ ਇਸ ਕਰਕੇ ਹੈ ਕਿਉਂਕਿ ਜਿਹੜੇ ਪੰਜਾਬੀ ਗੀਤ ਨੇ ਉਹ ਇਕੱਲੇ ਪੰਜਾਬ 'ਚ ਨਹੀਂ ਸਾਰੀ ਦੁਨੀਆਂ 'ਚ ਹੀ ਲੋਕ ਸੁਣਦੇ ਨੇ ਚਾਹੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਮਝ ਆਵੇ ਜਾਂ ਨਾ ਆਵੇ ਉਹ ਹਰ ਗੱਡੀ ਦੇ ਵਿੱਚ ਅੱਜ ਕੱਲ੍ਹ ਪੰਜਾਬੀ ਗੀਤ ਹੀ ਚੱਲਦਾ ਇਕੱਲਾ ਗੀਤ ਨਹੀਂ ਕਵਾਲੀਆਂ ਵੀ ਹੋ ਗਈਆਂ ਲੋਕ ਜਿਹੜੇ ਲੋਕ ਕਵਾਲੀਆਂ ਬਹੁਤ ਪਸੰਦ ਕਰਦੇ ਨੇ ਉਹ ਪੰਜਾਬ ਦੀਆਂ ਕਵਾਲੀਆਂ ਬਹੁਤ ਸੁਣਦੇ ਨੇ ਚਾਹੇ ਉਹ ਗਵਾਂਢੀ ਮੁਲਕ ਦੇ ਪੰਜਾਬ ਦੀ ਕਵਾਲੀ ਹੋਵੇ ਜਾਂ ਸਾਡੇ ਮੁਲਕ ਦੀ ਕ ਕਵਾਲੀ ਹੋਵੇ ਬਾਹਰਲੇ ਦੇਸ਼ਾਂ 'ਚ ਵੀ ਜਿੱਥੇ ਜਾ ਕੇ ਪੰਜਾਬੀ ਵਸੇ ਨੇ ਕੀ ਇੰਗਲੈਂਡ ਹੋ ਗਿਆ ਕੀ ਆਸਟ੍ਰੇਲੀਆ ਹੋ ਗਿਆ ਕੀ ਕਨੇਡਾ ਹੋ ਗਿਆ ਉੱਥੇ ਵੀ ਪੰਜਾਬੀ ਦੀ ਪੰਜਾਬੀਆਂ ਨੇ ਆਪਣੀ ਛਾਪ ਤਾਂ ਛੱਡ ਦਿੱਤੀ ਹੈ ਹੁਣ ਇਹਦਾ ਮੁੱਖ ਕਾਰਨ ਇਹੀ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈਗੀ ਉਹ ਸਮਝਣੀ ਬਹੁਤ ਸੌਖੀ ਹੈ ਅਤੇ ਗੀਤਾਂ 'ਚ ਵੀ ਲੋਕਾਂ ਨੂੰ ਬਹੁਤ ਪਸੰਦ ਹੈ ਪੰਜਾਬੀ ਭਾਸ਼ਾ ਸੁਣਨੀ ਤਾਂ ਅੱਜ ਕੱਲ੍ਹ ਹਰ ਬੰਦਾ ਹੀ ਪੰਜਾਬੀ ਗੀਤ ਸੁਣਦਾ ਇੱਥੋਂ ਪਤਾ ਲੱਗਦਾ ਕਿ ਸਾਡੀ ਜਿਹੜੀ ਭਾਸ਼ਾ ਹੈ ਉਹ ਬਾਕੀ ਖੇਤਰ ਦੇ ਉਪਭਾਸ਼ਾਵਾਂ ਤੋਂ ਵੱਖਰੀ ਕਿਉਂ ਹੈ